ਸਪੀਕ ਓਲ ਦਾ ਫੋਲਇੰਗ ਨੇਮ ਔਰਫ ਓਫ ਫੂਲ ਆਈ ਏ ਟੇਮ ਹਿੱਟ ਐਫ ਕਾ ਡੋਵਿਨ ਫੇਸਲ ਕਵੀਨ ਲੈਬ ਲੀ ਵਜ